ਅੱਜ ਕੱਲ੍ਹ ਮਨੁੱਖ ਵਿੱਚ ਆਲਸੀਪਣ ਬਹੁਤ ਛਾਅ ਰਿਹਾ ਹੈ ਅੱਜ ਦੇ ਤਕਨੀਕੀ ਯੁੱਗ ਵਿੱਚ ਜ਼ਿਆਦਾਤਰ ਕੰਮ ਮੋਬਾਈਲ ਫੋਨ ਅਤੇ ਲੈਪਟੋਪ ਦੁਆਰਾ ਹੀ ਕੀਤੇ ਜਾਂਦੇ ਹਨ ਜਿਹੜੇ ਬੰਦੇ ਦਫਤਰ ਵਿੱਚ ਜਾਂਦੇ ਹਨ ਉਨ੍ਹਾਂ ਦਾ ਕੰਮ ਜ਼ਿਆਦਾਤਰ ਬੈਠ ਕੇ ਹੀ ਹੁੰਦਾ ਹੈ ਬੈਠੇ ਬੈਠੇ ਕੰਮ ਕਰਨ ਨਾਲ ਉਨ੍ਹਾਂ ਦਾ ਇੱਕ ਤਾਂ ਮੋਟਾਪਾ ਬਹੁਤ ਵੱਧਦਾ ਹੈ ਚਰਬੀ ਬਹੁਤ ਵੱਧਦੀ ਹੈ ਜਿਸ ਨਾਲ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਹਨ ਬੰਦੇ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਅਤੇ ਦਿਲ ਤੋਂ ਲੈ ਕੇ ਵੀ ਬਹੁਤ ਬਿਮਾਰੀਆਂ ਲੱਗਦੀਆਂ ਹਨ ਅਤੇ ਇਸ ਵਿੱਚ ਜੇਕਰ ਕਸਰਤ ਨਾ ਕਰਾਂਗੇ ਤਾਂ ਨਾ ਸਰੀਰ ਬੇਕਾਰ ਹੋ ਜਾਵੇਗਾ ਆਪਣੇ ਸਰੀਰ ਨੂੰ ਸਿਹਤਮੰਦ ਬਣਾਉਣ ਲਈ ਸਾਡੇ ਲਈ ਕਸਰਤ ਬਹੁਤ ਜ਼ਰੂਰੀ ਹੈ ਜਿਹੜਾ ਬੰਦਾ ਕਸਰਤ ਨਹੀਂ ਕਰ ਸਕਦਾ ਉਹ ਕੋਈ ਨਾਚ ਕਰ ਲਵੇ ਇਸ ਵਿੱਚ ਭੰਗੜਾ ਆਪਾਂ ਭੰਗੜਾ ਐਰੋਬਿਕਸ ਨੂੰ ਇੱਕ ਮਸ਼ਹੂਰ ਕਸਰਤ ਮੰਨਦੇ ਹਾਂ ਇਸਨੂੰ ਇੱਕ ਕਾਰਡੀਓ ਕਸਰਤ ਵੀ ਮੰਨੀ ਜਾਂਦੀ ਹੈ ਇਹ ਵੈਸੇ ਵੀ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਨਾਚ ਮੰਨਿਆ ਜਾਂਦਾ ਹੈ ਪੰਜਾਬ ਦੇ ਲੋਕ ਇਸ ਨੂੰ ਬਹੁਤ ਹੀ ਜੋਸ਼ੀਲੇ ਤਰੀਕੇ ਨਾਲ ਕਰਦੇ ਹਨ ਜੇਕਰ ਕੋਈ ਵਿਆਹ ਸ਼ਾਦੀ ਆਉਂਦੀ ਹੈ ਤਾਂ ਇਹ ਬਹੁਤ ਫੁਰਤੀਲੇ ਹੋ ਕੇ ਇਸ ਨਾਚ ਨੂੰ ਕਰਦੇ ਹਨ ਕਿਉਂਕਿ ਇਹ ਇੱਕ ਤੇਜ਼ ਬੀਟ ਵਾਲੇ ਗਾਣੇ ਹੁੰਦੇ ਹਨ ਅਤੇ ਇਹ ਮਨੁੱਖ ਵਿੱਚ ਇੱਕ ਅਲੱਗ ਹੀ ਜੋਸ਼ ਪੈਦਾ ਕਰਦੇ ਹਨ ਇੱਕ ਅਲੱਗ ਹੀ ਫੁਰਤੀ ਪੈਦਾ ਕਰਦੇ ਹਨ ਜੇਕਰ ਮ ਮਨੁੱਖ ਆਪਣੇ ਆਪਣੇ ਜੀਵਨ ਤੋਂ ਬੋਰੀਅਤ ਮ ਮਹਿਸੂਸ ਕਰਦਾ ਹੈ ਤਾਂ ਇਹ ਇੱਕ ਮਨੋਰੰਜਨ ਦਾ ਵੀ ਉਹ ਸਾਧਨ ਹੈ ਕਿ ਆਪਾਂ ਆਪਣੇ ਮਨਪਸੰਦ ਗੀਤ ਲਗਾ ਕੇ ਇਸ ਬੋਰੀਅਤ ਨੂੰ ਹਟਾ ਸਕੀਏ ਅਤੇ ਸਰੀਰਿਕ ਅਤੇ ਮਾਨਸਿਕ ਸਿਹਤ ਵਿੱਚ ਵੀ ਇਹ ਸਕਾਰਾਤਮਕ ਬਦਲਾਅ ਲੈ ਕੇ ਆਉਂਦਾ ਹੈ ਭੰਗੜਾ ਐਰੋਬਿਕਸ ਇੱਕ ਬਹੁਤ ਹੀ ਵਧੀਆ ਚੀਜ਼ ਹੈ ਜੋ ਕਿ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਜਿਸ ਨਾਲ ਆਪਣਾ ਸਰੀਰ ਵਧੀਆ ਚੱਲ ਸਕੇ ਅਤੇ ਆਪਾਂ ਹਰ ਬਿਮਾਰੀ ਤੋਂ ਦੂਰ ਰਹਿ ਸਕੀਏ ਇਸ ਵਿੱਚ ਸਟੈਪਸ ਵੀ ਇਸ ਤਰ੍ਹਾਂ ਦੇ ਹੁੰਦੇ ਹਨ ਜਿਸ ਨਾਲ ਆਪਣਾ ਸਰੀਰ ਬਹੁਤ ਹਿਲਦਾ ਡੁਲਦਾ ਰਹੇ ਅਤੇ ਬਸ ਆਪਾਂ ਨੂੰ ਇਹ ਕਰਨਾ ਚਾਹੀਦਾ ਹੈ ਧੰਨਵਾਦ